ਸਭ ਤੋਂ ਜ਼ਿਆਦਾ ਅੱਜ ਦੇ ਅੱਜ ਦੇ ਯੁੱਗ ਵਿੱਚ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਕਿਉਂਕਿ ਸਰਕਾਰ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੰਦੀ ਕਿਸਾਨਾਂ ਦੀ ਫ਼ਸਲ ਖਰਾਬ ਹੋ ਜਾਂਦੀ ਹੈ ਤਾਂ ਉਹਨਾਂ ਦੇ ਸਿਰ ਕਰਜ਼ਾ ਚੜ੍ਹ ਜਾਂਦਾ ਹੈ ਜਿਸ ਕਾਰਨ ਉਹਨਾਂ ਜਿਸ ਕਾਰਨ ਉਹ ਖੁਦਕੁਸ਼ੀ ਕਰ ਲੈਂਦੇ ਹਨ ਸਰਕਾਰ ਨੂੰ ਕਿਸਾਨਾਂ ਦੇ ਪ੍ਰਤੀ ਕੁਝ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕਿਸਾਨ ਖੁਦਕੁਸ਼ੀ ਤੋਂ ਬਚ ਸਕਣ ਪਰ ਸਰਕਾਰ ਨੂੰ ਅੰਨ ਅੰਨ ਤੋਂ ਹੀ ਮਤਲਬ ਹੁੰਦਾ ਹੈ ਪਰ ਅੰਨ ਨੂੰ ਉਗਾਉਣ ਵਾਲਾ ਉਗਾਉਣ ਵਾਲੇ ਦਾ ਕੋਈ ਫਰਕ ਹੀ ਨਹੀਂ ਪੈਂਦਾ ਕਿਸਾਨ ਅੱਜ ਤੋਂ ਜ਼ਿਆਦਾ ਕਿਸਾਨ ਮਰ ਰਿਹਾ ਹੈ ਕਿਸਾਨ ਦਾ ਕਰਜ਼ਾ ਇੰਨਾਂ ਜ਼ਿਆਦਾ ਹੋ ਜਾਂਦਾ ਹੈ ਕਿ ਉਹ ਉਸਨੂੰ ਚੁਕਾਉਣ ਦੇ ਹਾਲਾਤ ਵਿੱਚ ਨਹੀਂ ਰਹਿੰਦਾ ਜਦੋਂ ਉਸ ਤੋਂ ਕਰਜ਼ਾ ਚੁਕਾਇਆ ਨਹੀਂ ਜਾਂਦਾ ਤਾਂ ਉਹ ਖੁਦਕੁਸ਼ੀ ਦਾ ਸਾਧਨ ਅਪਣਾਉਂਦਾ ਹੈ ਕਿਉਂਕਿ ਕਿਸਾਨਾਂ ਫਿਰ ਖੁਦਕੁਸ਼ੀ ਕਰਨ ਤੋਂ ਬਾਅਦ ਸਰਕਾਰ ਉਸ ਨੂੰ ਲੱਖ ਦੋ ਲੱਖ ਤਿੰਨ ਲੱਖ ਦਾ ਮੁਆਵਜ਼ਾ ਦਿੰਦੀ ਹੈ ਅਤੇ ਫਿਰ ਉਸ ਨੂੰ ਮਾ ਉਸ ਮਾਮਲੇ ਨੂੰ ਦਬਾਅ ਦਿੱਤਾ ਜਾਂਦਾ ਹੈ